ਹੈਲੋ ਹਾਂਜੀ ਨਮਸਤੇ ਮੈਂ ਸੀਮਾ ਦੇਵੀ ਸੁਜਾਨਪੁਰ ਤੋਂ ਬੋਲਦੀ ਹਾਂ ਹੁਣ ਮੈਨੂੰ ਇੱਥੇ ਆਪਣੇ ਬਚਪਨ ਦੇ ਬਾਰੇ ਜੋ ਵੀ ਖੇਡਾਂ ਖੇਡੀਆਂ ਨੇ ਉਹਨਾਂ ਦੇ ਬਾਰੇ ਦੱਸਣਾ ਜ਼ਰੂਰੀ ਹੋ ਗਿਆ ਹੈ ਜਿੱਦਾਂ ਕਿ ਅਸੀਂ ਬਚਪਨ 'ਚ ਖੇਡਦੇ ਸੀ ਮਤਲਬ ਕਿ ਲੁੱਕਣ ਮੀਟੀ ਖੇਡਦੇ ਸੀ ਜਿੱਦਾਂ ਕਿ ਲੁੱਕਣ ਮੀਟੀ ਜਿੱਦਾਂ ਚਾਰ ਪੰਜ ਬੱਚੇ ਹੁੰਦੇ ਅਤੇ ਚਾਰ ਪੰਜ ਤੋਂ ਵੱਧ ਵੀ ਹੋ ਜਾਂਦੇ ਹਨ ਵੀ ਅਸੀਂ ਇੱਕ ਜਣੇ ਨੇ ਲੁੱਕ ਜਾਣਾ ਅਤੇ ਬਾਕੀਆਂ ਨੂੰ ਸਾਰਿਆਂ ਨੂੰ ਸਾਰਿਆਂ ਨੇ ਸਾਰਿਆਂ ਨੂੰ ਤੋਪਣਾ ਅਤੇ ਫਿਰ ਉਹ ਸਾਰਿਆਂ ਨੇ ਆਪਣੀ ਆਪਣੀ ਜਗ੍ਹਾ 'ਚ ਲੁੱਕ ਜਾਣਾ ਅਤੇ ਅਸੀਂ ਜਿਹੜੇ ਜਿਹਦੀ ਇੱਕ ਦੀ ਟਰਨ ਆਉਂਦੀ ਸੀ ਅਤੇ ਉਸ ਨੇ ਸਾਰਿਆਂ ਨੂੰ ਹਰ ਜਗ੍ਹਾ ਜਾ ਕੇ ਤੋਪਣਾ ਅਤੇ ਹੱਥ ਲਗਾ ਕੇ ਉਹਨੂੰ ਆਊਟ ਕਰ ਦੇਣਾ ਜਿੱਦਾਂ ਕਿ ਅਸੀਂ ਹੋਰ ਕੀ ਲੁੱਕਣ ਮੀਟੀ ਖੇ ਖੇਡੀ ਫਿਰ ਉਸ ਤੋਂ ਬਾਅਦ ਅਸੀਂ ਖੇਡਦੇ ਸੀ ਖੋ ਖੋ ਖੇਡਣੀ ਜਿੱਦਾਂ ਕਿ ਲਾਈਨ ਬਣਾ ਕੇ ਅਸੀਂ ਸਾਰੇ ਲਾਈਨ ਬਣਾ ਕੇ ਬੱਚਿਆਂ ਨੇ ਬੈਠ ਜਾਣਾ ਅਤੇ ਇੱਕ ਜਣੇ ਦੀ ਮਾਟੀ ਆਉਣੀ ਤਾਂ ਉਸ ਨੇ ਹੱਥ ਲਗਾ ਕੇ ਵਾਰੀ ਵਾਰੀ ਸਾਰਿਆਂ ਨੂੰ ਮੌਕਾ ਦੇਣਾ ਖੇਡਣ ਦਾ ਇੱਦਾਂ ਕਿ ਅਸੀਂ ਮਤਲਬ ਕਿ ਖਿੱਦੂ ਵੀ ਖੇਡਦੇ ਹਾਂ ਖਿੱਦੂ ਜਿੱਦਾਂ ਅਸੀਂ ਖੇਡਦੇ ਸੀ ਖਿੱਦੂ ਜਿੱਦਾਂ ਖੇਡਦੇ ਸੀ ਕੀ ਇੱਕ ਇੱਕ ਜਣੇ ਨੂੰ ਹੱਥ ਲਗਾ ਕੇ ਊ ਉਹਦਾ ਟਰਨ ਦੇਣੀ ਅਤੇ ਬਾਕੀਆਂ ਨੇ ਆਪਣੀ ਆਪਣੀ ਜਗ੍ਹਾ 'ਤੇ ਬੈਠ ਰਹਿਣਾ ਅਤੇ ਉਹਨੂੰ ਹੱਥ ਲਗਾ ਕੇ ਆਊਟ ਕਰ ਦੇਣਾ ਅਤੇ ਇੱਦਾਂ ਹੀ ਅਸੀਂ ਹੋਰ ਖੇਡੀਆਂ ਖੇਡਾਂ ਖੇਡਦੇ ਹਾਂ ਕਿ ਫੁੱਟਬਾਲ ਵਗੈਰਾ ਵੀ ਅਸੀਂ ਸਕੂਲ ਵਿੱਚ ਖੇਡ ਲੈਂਦੇ ਸੀ ਹਾਂਜੀ ਜਿੱਦਾਂ ਕਿ ਅੱਠ ਜਣੇ ਉੱਧਰ ਹੋ ਜਾਣੇ ਅੱਠ ਜਣੇ ਉੱਧਰ ਹੋ ਜਾਣੇ ਦੈੱਨ ਟੀਮ ਬਣਾ ਕੇ ਖੇਡ ਲੈਣੀ ਜੀ ਹਾਂਜੀ ਧੰਨਵਾਦ ਮੈਨੂੰ ਤੇ